ਹੈਲੋ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਸਾਡੇ ਇੱਥੇ ਗੁਲਸ਼ਨ ਸਵੀਟ ਹਾਊਸ ਹੈ ਇੱਥੇ ਬਹੁਤ ਹੀ ਵਧੀਆ ਵਰਾਈਟੀ ਮਿਲਦੀ ਹੈ ਖੋਏ ਦੀ ਬਰਫੀ ਹੋ ਗਈ ਜਿਵੇਂ ਕਿ ਸਮੋਸੇ ਵਗੈਰਾ ਹੋ ਗਏ ਇੱਥੇ ਛੋਲੇ ਭਟੂਰੇ ਹੋ ਗਏ ਇੱਥੇ ਜਿਵੇਂ ਸਮੋਸੇ ਵੀ ਇੱਥੇ ਕਈ ਤਾਂ ਹੁੰਦੇ ਨਾ ਆਲੂਆਂ ਵਾਲੇ ਇੱਥੇ ਦਾ ਸਮੋਸਾ ਬਹੁਤ ਵਧੀਆ ਜਿਵੇਂ ਕਿ ਵਿੱਚ ਪਨੀਰ ਪਨੀਰ ਵਾਲਾ ਹੁੰਦਾ ਵਿੱਚ ਡ੍ਰਾਈ ਫਰੂਟ ਪਾਇਆ ਹੁੰਦਾ ਅਤੇ ਕਾਫੀ ਵਧੀਆ ਵਰਾਈਟੀ ਮਿਲਦੀ ਆ ਅਸੀ ਇੱਥੇ ਹੀ ਔਡਰ ਕਰਦੇ ਹਾਂ ਬਾਕੀ ਇੱਕ ਸ਼ਰਮੇ ਦਾ ਹੋਟਲ ਹੈਗਾ ਉੱਥੇ ਵੀ ਸਮੋਸੇ ਬਹੁਤ ਵਧੀਆ ਮਿਲਦੇ ਹੈ ਮਠਿਆਈ ਵਗੈਰਾ ਵੀ ਬਹੁਤ ਵਧੀਆ ਮਿਲਦੀ ਹੈ ਅਤੇ ਇੱਕ ਹੋਰ ਸਾਡੇ ਸ਼ੰਭੂ ਦਾ ਹੋਟਲ ਹੈਗਾ ਉੱਥੇ ਵੀ ਬਹੁਤ ਵਧੀਆ ਵਿਰਾਈਟੀ ਮਿਲਦੀ ਹੈ ਹਾਂਜੀ ਤਰ੍ਹਾਂ ਤਰ੍ਹਾਂ ਦੀਆਂ ਬਰਫੀਆਂ ਵਗੈਰਾ ਮਠਿਆਈ ਅਤੇ ਕਾਫੀ ਹਾਂਜੀ ਨਹੀਂ ਨਹੀਂ ਅਸੀਂ ਕਿਉਂਕਿ ਅਸੀਂ ਤਾਂ ਔਡਰ ਕਰਦੇ ਹੀ ਰਹਿੰਦੇ ਹਾਂ ਹਾਂਜੀ ਬਾਕੀ ਇਹਨਾਂ ਵਿੱਚ ਕੋਈ ਮਿਲਾਵਟ ਨਹੀਂ ਹੁੰਦੀ ਮਠਿਆਈਆਂ ਵਿੱਚ ਵਧੀਆ ਤਰੀਕੇ ਨਾਲ ਸਾ ਸਫਾਈ ਹਾਂਜੀ ਹਾਂਜੀ ਬਿਲਕੁਲ ਤੁਸੀਂ ਇੱਥੋਂ ਖਾ ਕੇ ਦੇਖੋ ਤੁਸੀਂ ਇੱਥੇ ਆਉ ਖਾ ਕੇ ਦੇਖੋ ਤੁਸੀਂ ਖੁਦ ਕਹੋਂਗੇ ਅੱਛਾ ਜੀ ਹਾਂਜੀ ਨਹੀਂ ਨਹੀਂ ਤੁਸੀਂ ਇੱਥੇ ਖੁਦ ਆ ਕੇ ਖਾ ਕੇ ਦੇਖੋਂਗੇ ਨਾ ਤੁਸੀਂ ਖੁਦ ਕਹੋਂਗੇ ਹਾਂਜੀ ਸਾਡੇ ਮਤਲਬ ਬਹੁਤ ਜ਼ਿਆਦਾ ਵਧੀਆ ਮਿਠਾਈ ਵਗੈਰਾ ਹੈਗੀ ਆ ਹਾਂਜੀ ਕਿਵੇਂ ਹੋਰ ਸੁਣਾਉ ਕਾਫੀ ਇੱਥੇ ਹਾਂਜੀ ਨਹੀਂ ਅਸੀਂ ਅਸੀਂ ਤਾਂ ਮਤਲਬ ਤੁਸੀਂ ਇੱਥੇ ਹੋਟਲ ਦਾ ਇੱਕ ਵਾਰੀ ਕਿਸੇ ਤੋਂ ਵੀ ਪੁੱਛ ਲਉ ਤਾਂ ਇਹ ਫੇਮਸ ਹੈ ਹਾਂਜੀ ਸਾਰਿਆਂ ਨੂੰ ਪੁੱਛ ਲਉ ਵੀ ਇਹ ਫੇਮਸ ਹੈ ਅਤੇ ਹੋਟਲ ਦੀ ਮਠਿਆਈ ਵਗੈਰਾ ਹੋ ਗਈ ਕੋਈ ਮਤਲਬ ਇੱਥੇ ਕੋਈ ਬਰਫੀ ਕੋਈ ਰ ਮ ਰਸ ਮਲਾਈ ਹੋ ਗਈ ਜਿਵੇਂ ਕਿ ਹਾਂਜੀ ਕਾਫੀ ਵਧੀਆ ਮਿਲਦੀ ਹੈ ਕੋਈ ਕਈ ਦੁਕਾਨ 'ਤੇ ਆਪਾਂ ਜਾਂਦੇ ਹਾਂ ਨਾ ਕਿ ਵੀ ਜਿਵੇਂ ਰਸਗੁੱਲਿਆਂ ਵਿੱਚ ਗੰਢਾਂ ਜਿਹੀਆਂ ਹੁੰਦੀਆਂ ਹਾਂਜੀ ਪਰ ਨਹੀਂ ਐਨਾ ਤਾਂ ਇਹ ਹੋਟਲਾਂ ਦਾ ਬਿਲਕੁਲ ਕੰਮ ਐਡਾ ਵਧੀਆ ਨਾ ਕਿ ਤੁਸੀਂ ਖੁਦ ਮਠਿਆਈ ਖਾ ਕੇ ਤੁਸੀਂ ਕਹੋਂਗੇ ਵੀ ਮੈਂ ਤੁਹਾਡੇ ਇੱਥੇ ਮਤਲਬ ਮਠਿਆਈ ਲੈਣ ਆਵਾਂ ਹਾਂਜੀ ਹਾਂਜੀ ਨਹੀਂ ਤੁਸੀਂ ਕੋਈ ਨਹੀਂ ਤੁਸੀਂ ਖਾ ਕੇ ਵੀ ਦੇਖੋ ਜੇ ਤੁਹਾਨੂੰ ਖੁਦ ਤੁਸੀਂ ਆਪ ਹੀ ਕਹੋਂਗੇ ਹਾਂਜੀ ਨਹੀਂ ਤੁਹਾਡੀ ਵਾਕਈ ਤੁਸੀਂ ਜਿਵੇਂ ਕਿਹਾ ਸੀ ਇਸ ਤੋਂ ਵੀ ਵੱਧ ਮਠਿਆਈ ਵਧੀਆ ਲੱਗੀ ਸਾਨੂੰ ਅਤੇ ਤੁਸੀਂ ਖੁਦ ਇੱਥੋਂ ਲੈਣ ਆਉਣਗੇ ਹਾਂਜੀ ਵੈਲਕਮ ਵੈਲਕਮ ਵੈਲਕਮ